ਹੈਲੋ ਮੇਰਾ ਨੇਮ ਸਾਈਂ ਹੈ ਅਤੇ ਮੈਂ ਖੂਨਦਾਨ ਕੈਂਪ ਦੇ ਵਿੱਚ ਆਪਦਾ ਖੂਨ ਦਾਨ ਕਰਨ ਲਈ ਰਜਿਸਟਰ ਕਰਨਾ ਚਾਹੁੰਦਾ ਹਾਂ ਮੇਰਾ ਘਰ ਦਾ ਪਤਾ ਹੈ ਪੰਜਾਬ ਫਾਜ਼ਿਲਕਾ ਗਾਂਧੀ ਨਗਰ ਅਤੇ ਮੇਰਾ ਫੋਨ ਨੰਬਰ ਹੈ ਛੇ ਅੱਠ ਇੱਕ ਇੱਕ ਤਿੰਨ ਚਾਰ ਪੰਜ ਛੇ ਨੌਂ ਜੀਰੋ ਅਤੇ ਮੈਂ ਫਿਜ਼ੀਕਲੀ ਪੂਰਾ ਫਿੱਟ ਹਾਂ ਅਤੇ ਮੈਂ ਅੱਗੇ ਵੀ ਬਹੁਤ ਵਜ ਵਾਰੀ ਖੂਨ ਦਾਨ ਕਰ ਚੁੱਕਿਆ ਹਾਂ ਅਤੇ ਇਸ ਲਈ ਮੈਂ ਇਸ ਇਸ ਕੈਂਪ ਦੇ ਵਿੱਚ ਰਜਿਸਟਰ ਕਰਨਾ ਚਾਹੁੰਦਾ ਖੂਨ ਦਾਨ ਮੇਰੇ ਖਿਆਲ ਤੋਂ ਹਰ ਕਿਸੀ ਨੂੰ ਕਰਨਾ ਚਾਹੀਦਾ ਏ ਇਹ ਬਹੁਤ ਚੰਗਾ ਕੰਮ ਹੁੰਦਾ ਹੈ ਅਤੇ ਮੇਰੇ ਖਿਆਲ ਵਿੱਚ ਖੂਨਦਾਨ ਬਿਲਕੁਲ ਸਹੀ ਆ ਮੇਰੇ ਕੋਲ ਖੂਨ ਆਪਦੇ ਬਲੱਡ ਦੀ ਰਿਪੋਟ ਵੀ ਹੈ ਅਤੇ ਮੈਂ ਬਿਲਕੁਲ ਫਿੱਟ ਹਾਂ ਇਸ ਲਈ ਮੈਂ ਕ ਇਸ ਖੂਨਦਾਨ ਕੈਂਪ ਦੇ ਵਿੱਚ ਰਜਿਸਟਰ ਕਰਨਾ ਚਾਹੁੰਦਾ ਹਾਂ ਧੰਨਵਾਦ